ਪੰਜਾਬ ਵਿੱਚ ਕਲਾ ਅਤੇ ਸ਼ਿਲਪਕਾਰੀ ਖੇਤਰ ਰਾਜ ਵਿੱਚ ਆਪਾਂ ਕਾਫੀ ਇੰਪਰੂਵਮੈਂਟ ਕਰ ਸਕਦੇ ਹਾਂ ਪੰਜਾਬ ਵਿੱਚ ਜਿਵੇਂ ਆਈ ਟੀ ਆਈ ਹਨ ਨਵੇਂ ਨਵੇਂ ਤਰ੍ਹਾਂ ਦੇ ਕੋਰਸ ਹਨ ਉਹਦੇ ਵਿੱਚ ਜਿਹਦੇ ਨਾਲ

ਹਾਈ ਐਜੂਕੇਸ਼ਨ ਜਿ ਜਿਹੜਾ ਨਹੀਂ ਲੈਣਾ ਚਾਹੁੰਦਾ ਉਹ ਸ਼ੋਰਟ ਟਰਮ ਕੋਰਸ ਆਈ ਟੀ ਆਈ ਵਿੱਚ ਕਰਕੇ ਆਪਣਾ ਰੁਜ਼ਗਾਰ ਚਲਾ ਸਕਦੇ ਹਨ ਕਈਆਂ ਨੂੰ ਪੈਸਿਆਂ ਦੀ ਘਾਟ ਕਰਕੇ ਪੇਰੈਂਟਸ ਨਹੀਂ ਪੜ੍ਹਾ ਸਕਦੇ ਉਹ ਸ਼ੋਰਟ ਟਰਮ ਆਈ ਟੀ ਆਈ ਵਿੱਚ ਕੋਰਸ ਡਿਫਰੈਂਟ ਤਰ੍ਹਾਂ ਦੇ ਕਰ ਸਕਦੇ ਹਨ ਜਿਸ ਨਾਲ ਉਹਨਾਂ ਦਾ ਜੀਵਨ ਪੱਧਰ ਉੱਚਾ ਹੋ ਸਕਦਾ ਹੈ ਨਵੀਂ ਸੰਗੀਤ ਨਾਟਕ ਅਕੈਡਮੀਆਂ ਹਨ ਖੋਲ੍ਹੀਆਂ ਜਾਣ ਕੁਛ ਕੁਛ ਹੈ ਵੀ ਹਨ ਪੰਜਾਬ ਵਿੱਚ ਜਿਸ ਵਿੱਚ ਪਾਰਟੀਸੀਪੇਟ ਕਰਕੇ ਆਪਣਾ ਗਾਂਹਾਂ ਫਿਲਮੀ ਕੇ ਖੇਤਰ ਵੱਲ ਜੋ ਇੰਟਰਸਟਿਡ ਹਨ ਬੱਚੇ ਉਹ ਜਾ ਸਕਦੇ ਹਨ ਇੱਕ ਡਿਫਰੈਂਟ ਲੈਵਲ 'ਤੇ ਉੱਚੇ ਉੱਠ ਸਕਦੇ ਹਨ ਅਤੇ ਨਾਟਕ ਅਕੈਡਮੀਆਂ ਹੋਰ ਖੋਲ੍ਹੀਆਂ ਜਾਣ ਤਾਂ ਜੋ ਜਿਹੜੇ ਆਪਣੇ ਐਜੂਕੇਸ਼ਨ ਤੋਂ ਇਲਾਵਾ ਫਿਲਮੀ ਖੇਤਰ ਵਿੱਚ ਜਾਣਾ ਚਾਹੁੰਦੇ ਨੇ ਉਹ ਉਹਦੇ ਵਿੱਚ ਭਾਗ ਲੈ ਕੇ ਆਪਣਾ ਜੀਵਨ ਸਫਲ ਕਰ ਸਕਦੇ ਨੇ